ਪੰਜਾਬ ਵਿਚ ਹਰ ਇੱਕ ਬੰਦੇ ਨੇ ਰੇਲ ਗੱਡੀ ਵਿਚ ਸਫ਼ਰ ਕੀਤਾ ਹੈ ਜਿਵੇ ਕਿ ਮੈਂ ਤੁਹਾਨੂੰ ਆਪਣੀ ਗੱਲ ਕਰਨ ਜਾ ਰਿਹਾ ਹਾਂ ਮੈਂ ਵੀ ਰੇਲ ਗੱਡੀ ਦਾ ਸਫ਼ਰ ਕੀਤਾ ਹੈ ਇੱਥੋਂ ਪਟਨਾ ਸਾਹਿਬ ਤੱਕ ਅਸੀਂ ਇਹਤੇ ਸਿਰਫ ਜਨਰਲ ਡੱਬੇ ਵਿੱਚ ਗਏ ਸਾਂ ਜਿੱਥੇ ਕੀ ਜਿੱਥੇ ਜੇ ਗੱਲ ਆਪਾਂ ਗੱਲ ਕਰੀਏ ਸੀਟਾਂ ਦੀਆਂ ਸੀਟਾਂ ਬਹੁਤ ਹੀ ਬੇਕਾਰ ਸਨ ਵੀ ਜਿਵੇਂ ਕਿ ਸਾਨੂੰ ਬਹਿਣ ਵਿੱਚ ਬਹੁਤ ਤੰਗੀ ਹੋਈ ਸੀ ਜੇਕਰ ਗੱਲ ਕਰੀਏ ਸੀਟਾਂ ਵੱਡੀਆਂ ਵੱਡੀਆਂ ਅਪਾਰਟਮੈਂਟਸ ਦੀਆਂ ਜਿਵੇਂ ਕਿ ਤੁਹਾਡੇ ਮਹਿੰਗੇ ਤੋਂ ਬਹੁਤ ਮਹਿੰਗੇ ਉਹਨਾਂ ਵਿੱਚ ਸੀਟਾਂ ਬਹੁਤ ਹੀ ਜ਼ਿਆਦਾ ਵਧੀਆ ਹੁੰਦੀਆਂ ਹਨ ਜਿਵੇਂ ਕਿ ਉਹਨਾਂ ਵਿੱਚ ਸਾਨੂੰ ਰਾਤ ਰਹਿਣ ਵਾਸਤੇ ਕੰਬਲ ਵਗੈਰਾ ਵੀ ਦਿੱਤੇ ਜਾਂਦੇ ਹਨ ਜੇਕਰ ਸਫ਼ਰ ਦੂਰ ਦਾ ਹੈ ਨਾਲੇ ਸੀਟ ਵੀ ਜਿਹੜੀਆਂ ਫੋਮ ਵਾਲੀਆਂ ਹੁੰਦੀਆਂ ਹਨ ਜੇਕਰ ਗੱਲ ਕਰੀਏ ਆਪਾਂ ਇੰਜਨ ਦੀ ਇੰਜਨ ਜਿਹੜਾ ਅੱਜ ਕੱਲ੍ਹ ਉਦੋਂ ਚ ਚੱਲਦਾ ਸੀਗਾ ਉਹ ਪਹਿਲਾਂ ਡੀਜ਼ਲ ਵਾਲਾ ਚੱਲਦਾ ਸੀਗਾ ਜੋ ਕਿ ਬਹੁਤ ਸ਼ੋਰ ਕਰਦਾ ਸੀਗਾ ਉਹ ਬਹੁਤ ਹੀ ਪੋਲਿਊਸ਼ਨ ਕਰਦਾ ਸੀਗਾ ਜੀ ਜਿਹਦੇ ਨਾਲ ਲੋਕ ਹਵਾ ਪ੍ਰਦੂਸ਼ਿਤ ਹੁੰਦੀ ਸੀਗੀ ਜੇ ਗੱਲ ਕਰੀਏ ਆਪਾਂ ਸ਼ੋਰ ਦੀ ਜਦੋਂ ਰੇਲ ਗੱਡੀ ਫ਼ਲਾਈਓਵਰ ਥੱਲੋਂ ਲੰਘਦੀ ਆ ਉਹਦੇ ਪਹੀਏ ਬਹੁਤ ਅਵਾਜ਼ ਕਰਦੇ ਹਨ ਜੋ ਕਿ ਬਹੁਤ ਸ਼ੋਰ ਜ ਬੋ ਕਿ ਬਹੁਤ ਸ਼ੋਰ ਕਰਦੀਆਂ ਨੋਆਇਸ ਪਲਿਊਸ਼ਨ ਫੈਲਾਉਂਦੀਆਂ ਹਨ ਨਾਲੇ ਕਿ ਜੇਕਰ ਆਪਾਂ ਗੱਲ ਕਰੀਏ ਜੇ ਟਰੈਕ ਦੇ ਉੱਤੇ ਗੱਡੀ ਹੋਵੇ ਜੇਕਰ ਇਕਦਮ ਰੋਕਣੀ ਪੈ ਜਾਵੇ ਤਾਂ ਬਹੁਤ ਸ਼ੋਰ ਆਉਂਦਾ ਹੈ ਅਤੇ ਨਾਲੇ ਨਾਲੇ ਬਹੁਤ ਸ਼ੋਰ ਆਉਂਦਾ ਹੈ ਨਾਲੇ ਲੋਕ ਆਸੇ ਪਾਸੇ ਵਾਲੇ ਝਿਜਕਦੇ ਨੇ ਕਿ ਕੀ ਹੋ ਰਿਹਾ ਹੈ ਨਾਲੇ ਜੇਕਰ ਆਪਾਂ ਜੇ ਗੱਲ ਕੀਤੀ ਜਾਵੇ ਰੇਲ ਗੱਡੀ ਦੇ ਵਿੱਚ ਸਫ਼ਰ ਦੀ ਦੂਰ ਦੇ ਸਫ਼ਰ ਦੀ ਜੇਕਰ ਤੁਹਾਡੇ ਕੋਲ ਅਪਾਰਟਮੈਂਟਸ ਮਹਿੰਗੇ ਵਾਲੇ ਹੈਗੇ ਆ ਤਾਂ ਸਫ਼ਰ ਬਹੁਤ ਹੀ ਵਧੀਆ ਜਾਵੇਗਾ ਜੇਕਰ ਅਪਾਰਟਮੈਂਟ ਵਾਲੇ ਨਹੀਂ ਹੈਗੇ ਤਾਂ ਸਫ਼ਰ ਬਹੁਤ ਬੇਕਾਰ ਜਾਂਦਾ ਹੈ ਨਾਲੇ ਜੇਕਰ ਇੰਜਨ ਦੀ ਗੱਲ ਕੀਤੀ ਜਾਂਦੀ ਆ ਇੰਜਨ ਤਾਂ ਬਹੁਤ ਹੀ ਪੋਲੀਊਸ਼ਨ ਪਰ ਪੋਲੀਊਸ਼ਨ ਪ੍ਰੋਡਿਊਸ ਕਰਦਾ ਹੈ ਜਿਵੇਂ ਕਿ ਹਵਾ ਪੋਲੀਊਸ਼ਨ ਹੋਰ ਵੀ ਜਿਵੇਂ ਹਵਾ ਪੋਲੀਊਸ਼ਨ ਨਾਲੇ ਬਹੁਤ ਸਾਰੀਆਂ ਚੀਜ਼ਾਂ ਪ੍ਰਦੂਸ਼ਿਤ ਕਰ ਰਹੇ ਹਾਂ